ਮੇਰਾ ਪਰਿਵਾਰ ਖ਼ਾਸ ਕਰਕੇ ਮੇਰੀ ਮਾਂ ਮੇਰੀ ਮਾਤਾ ਜੀ ਉਹ ਸ਼ੁਰੂ ਤੋਂ ਹੀ ਮੇਰੇ ਸ਼ੌਂਕਾਂ ਨੂੰ ਜਾਂ ਕਹਿ ਸਕਦੇ ਮੇਰੀ ਹਰੇਕ ਗੱਲ 'ਚ ਸਪੋਰਟ ਹੀ ਕੀਤੀ ਉਹਨਾਂ ਨੇ ਸਮਰਥਨ ਹੀ ਕਰਿਆ ਕਿਉਂਕਿ ਇਸ ਤਰਾਂ ਜਿਹੜਾ ਮੇਰਾ ਸ਼ੌਂਕ ਸੀ ਫੋਟੋ ਖਿੱਚਣ ਦਾ ਕੋਈ ਸਪੈਸ਼ਲੀ ਕੁਦਰਤ ਦੇ ਫੁੱਲਾਂ ਦੀਆਂ ਫੋਟੋ ਖਿੱਚਣ ਕਿਸੇ ਜਾਨਵਰ ਦੀਆਂ ਕੁਦਰਤੀ ਵਿਊ ਦੀਆਂ ਕੁਦਰਤੀ ਨਜ਼ਾਰੇ ਦੀਆਂ ਫੋਟੋਆਂ ਖਿੱਚਣਾ ਮੈਨੂੰ ਬੜੀਆ ਪਸੰਦ ਸੀ ਜਿੱਦਾਂ ਕਿ ਮੈਂ ਆਪਣੇ ਜਿਹੜਾ ਵੀ ਫੋਨ ਛੋਟੇ ਤੋਂ ਛੋਟਾ ਆਇਆ ਉਹ ਪਰ ਫੋਟੋ ਖਿੱਚਣੀਆਂ ਸਟਾਟ ਕੀਤੀਆਂ ਇਹਨਾਂ ਇਸ ਕਰਕੇ ਹੀ ਫੋਟੋ ਵਧੀਆ ਲੱਗੀਆਂ ਮੇਰੀਆਂ ਮੈਂ ਸਾਰੇ ਪਾਸੇ ਪਾਉਣ ਲੱਗਿਆ ਆਪਣਾ ਇੰਸਟਾਗ੍ਰਾਮ ਪਰ ਪੇਜ ਬਣਾਇਆ ਉਹਨੂੰ ਦੇਖਦੇ ਮੇਰੇ ਘਰਦਿਆਂ ਨੇ ਮੇਰੀ ਬੜੀ ਸਪੋਰਟ ਕੀਤੀ ਇਸ ਲਈ ਉਹਨਾਂ ਨੇ ਮੇਰਾ ਸ਼ੌਂਕ ਪੂਰਾ ਕਰਨ ਲਈ ਮੈਨੂੰ ਇੱਕ ਆਈਫੋਨ ਵੀ ਲੈ ਕੇ ਦਿੱਤਾ ਅਤੇ ਜਿਸ ਕਰਕੇ ਮੈਂ ਆਈਫੋਨ ਦੇ ਵਿੱਚ ਫੋਟੋਆਂ ਖਿੱਚਣੀਆਂ ਸਟਾਰਟ ਕੀਤੀਆਂ ਭਾਵੇਂ ਉਹ ਪੋਰਟਰੇਟ ਹੋ ਗਿਆ ਆਪਣੀਆਂ ਹੋਣ ਇਨਸਾਨਾਂ ਦੀਆਂ ਹੋਣ ਜਾਂ ਫੁੱਲਾਂ ਦੀਆਂ ਪੱਤੀਆਂ ਦੀਆਂ ਖੇਤਾਂ ਦੀਆਂ ਉਹਨਾਂ ਤੋਂ ਮੈਂ ਸਟਾਰਟ ਕੀਤਾ ਆਪਣੀਆਂ ਫੋਟੋਆਂ ਖਿੱਚੀਆਂ ਸਟਾਰਟ ਫੋਟੋਗਰਾਫੀ ਦਾ ਸ਼ੌਂਕ ਪੂਰਾ ਕਰਨ ਇਹਦੇ ਨਾਲ ਮੈਂ ਆਪਣੇ ਦੋਸਤਾਂ ਦੀ ਵਧੀਆ ਫੋਟੋ ਖਿੱਚਦੀ ਹਾਂ ਖਿੱਚਣੀ ਸਟਾਰਟ ਕੀਤੀਆਂ ਅਤੇ ਹੁਣ ਇਹ ਮੈਨੂੰ ਬੜਾ ਸਕੂਨ ਦਿੰਦਾ ਮੈਨੂੰ ਲੱਗਦਾ ਕਿ ਮੇਰਾ ਇਹ 'ਚ ਬਹੁਤ ਜ਼ਿਆਦਾ ਟੈਂਲੈਂਟ ਹੈ ਅਤੇ ਹੁਣ ਵੀ ਮੈਂ ਘੁੰਮਦਾ ਘੁੰਮਦਾ ਪਹਿਲਾਂ ਦੋ ਚਾਰ ਫੋਟੋਆਂ ਖਿੱਚ ਕੇ ਹੀ ਆਇਆ ਖੇਤ ਦੇ ਵਿੱਚ ਘੁੰਮਦਾ ਸੀ ਮੈਂ ਆਪਣੇ ਖੇਤ 'ਚ ਆਇਆ ਹੋਇਆ ਸੀ ਅਤੇ ਫੁੱਲਾਂ ਦੀਆਂ ਸਰੋਂ ਦੀਆਂ ਫੋਟੋਆਂ ਖਿੱਚਣੀਆਂ ਸਟਾਰਟ ਕੀਤੀਆਂ ਕਣਕਾਂ ਦੀਆਂ ਫੋਟੋਆਂ ਸਟਾਰਟ ਕੀਤੀਆਂ ਅਤੇ ਬਸ ਇੱਦਾਂ ਹੀ ਮੇਰੇ ਘਰ ਦੇ ਕਹਿੰਦੇ ਕੋਈ ਗੱਲ ਨਹੀਂ ਤੂੰ ਇਹਨੂੰ ਆਪਣਾ ਪ੍ਰੋਫੈਸ਼ਨ ਬੁਲਾ ਬਣਾ ਹੌਲੀ ਹੌਲੀ ਮੈਂ ਇੰਸਟਾਗਰਾਮ ਪਰ ਆਪਣੀ ਰੀਚ ਵਧੀਆ ਬਣਨ ਲੱਗ ਪਈ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਮੈਂ ਬਹੁਤ ਵਧੀਆ ਕਰ ਸਕਾਂ ਅਤੇ ਮੇਰੇ ਘਰਦਿਆਂ ਨੇ ਮੇਰੀ ਵ ਕਾਫ਼ੀ ਸਪੋਰਟ ਕੀਤੀ ਹੈ ਹੁਣ ਅੱਗੇ ਮੈਂ ਸੋਚ ਸ਼ਾਇਦ ਮੈਨੂੰ ਲੱਗਦਾ ਕਿ ਮੈਨੂੰ ਅੱਗੇ ਡੀ ਐਸ ਐਲ ਆਰ ਵਧੀਆ ਕੈਮਰਾ ਸੋਨੀ ਦਾ ਮਿਲ ਜਾਵੇ